ਸਾਡੇ ਖੇ ਖੇਡ ਖੇਤਰ ਵਿੱਚ ਬਠਿੰਡਾ ਵਿੱਚ ਇੱਕ ਸਟੇਟ ਖੇਡ ਦਾ ਸਟੇਡੀਅਮ ਬਣਿਆ ਹੋਇਆ ਜਿੱਥੇ ਜਾ ਕੇ ਹਰ ਰੋਜ਼ ਬੱਚੇ ਖੇ ਫੁੱਟਬਾਲ ਕ ਕ੍ਰਿਕਟ ਰਨਿੰਗ ਵਗੈਰਾ ਬਹੁਤ ਕੁਝ ਖੇਡਾਂ ਖੇਡਦੇ ਹਨ ਉੱਥੇ ਬਹੁਤ ਸਹੂਲਤਾਂ ਉਪਲਬਧ ਹਨ ਜਿਵੇਂ ਕਿ ਉੱਥੇ ਰਨਿੰਗ ਟਰੈਕ ਵਧੀਆ ਬਣੇ ਹੋਏ ਹਨ ਖ ਕ੍ਰਿਕਟ ਖੇਡਣ ਲਈ ਮੈਦਾਨ ਵਧੀਆ ਬਣਿਆ ਹੋਇਆ ਹੈ ਬੱਚਿਆਂ ਦੇ ਸਿਟਿੰਗ ਲਈ ਕੁਰਸੀਆਂ ਵਗੈਰਾ ਹਨ ਠੰਡੇ ਪਾਣੀ ਦਾ ਅਰੇਂਜਮੈਂਟ ਹੈ ਛਾਵੇਂ ਬੈਠਣ ਲਈ ਲਈ ਆਪਣੇ ਕੁਰਸੀਆਂ ਲੱਗੀਆਂ ਹੋਈਆਂ ਹਨ ਫਿਰ ਉੱਥੇ ਕ ਕਾਪੇ ਕਾਰਪੈਟ ਵਿਛੇ ਹੋਏ ਹਨ ਗਰੀਨ ਘਾਹ ਲੱਗਿਆ ਹੋਇਆ ਹੈ ਜਿਸ 'ਤੇ ਬੈਠ ਕੇ ਬੱਚੇ ਆਰਾਮ ਵਗੈਰਾ ਕਰ ਸਕਦੇ ਹਨ ਇਸ ਤਰ੍ਹਾਂ ਉੱਥੇ ਕ ਅਜਿਹਾ ਖੁੱਲ੍ਹਾ ਵਾਤਾਵਰਨ ਹੈ ਜਿੱਥੇ ਕਿ ਬ ਜਾ ਕੇ ਬੱ ਹਮੇਸ਼ਾ ਸਾਡਾ ਸਰ ਸਰੀਰਕ ਨੂੰ ਇੱਕ ਤੰਦਰੁਸਤੀ ਫੀਲ ਹੁੰਦੀ ਹੈ ਕਿ ਉੱਥੇ ਖੇਡਾਂ ਖੇਡਣ ਨਾਲ ਸਾਡੇ ਨੂੰ ਤੰਦਰੁਸਤੀ ਵੀ ਫੀਲ ਹੁੰਦੀ ਹੈ ਅਤੇ ਸਾਨੂੰ ਖੇਡਾਂ ਖੇਡ ਕੇ ਵਧੀਆ ਲੱਗਦਾ ਹੈ ਕਿਉਂਕਿ ਉਸ ਗਰਾਊਂਡ ਦੀ ਦੇ ਵਿੱਚ ਕੋਈ ਵੀ ਸੱਟ ਲੱਗਣ ਦਾ ਡਰ ਨਹੀਂ ਹੈ ਕਿ ਗਰਾਊਂਡ ਵਧੀਆ ਕ ਬਣਿਆ ਹੋਇਆ ਹੈ ਕੱਚਾ ਬਣਿਆ ਘਾਹ ਵੀ ਲੱਗਿਆ ਹੋਇਆ ਅਤੇ ਉਸ ਦੇ ਵਿੱਚ ਚੰਗੇ ਫੁੱਲ ਬੂਟੇ ਅਤੇ ਪੌਦੇ ਲੱਗੇ ਹੋਏ ਹਨ